ਸਤਿ ਸ਼੍ਰੀ ਅਕਾਲ ਸਰ ਮੈ ਨਾ ਇੱਕ ਕੈਬ ਬੁੱਕ ਕਰਨੀ ਸੀਗੀ ਹਰਿਮੰਦਰ ਸਾਹਿਬ ਜਾਣ ਨੂੰ ਜਿੱਦਾਂ ਕਿ ਅਸੀਂ ਇੱਥੋਂ ਘਰੋਂ ਤੁਰਦੇ ਹਾਂ ਤਾਂ ਅਸੀਂ ਜਾਂਦੇ ਹਾਂ ਨਵਾਂ ਸ਼ਹਿਰ ਵੀ ਰੁਕਣਾ ਹੈ ਖਟਕੜ ਕਲਾਂ ਉੱਥੇ ਵੀ ਰੁਕਣਾ ਉਸ ਤੋਂ ਅੱਗੇ ਜਾ ਕੇ ਜਿਵੇਂ ਹਵੇਲੀ ਆ ਗਈ ਹੈ ਨਾ ਉੱਥੇ ਵੀ ਰੁਕਣਾ ਫਿਰ ਜੇ ਕੋਈ ਪਾਰਕ ਆਉਂਦੀ ਹੋਈ ਬੱਚਿਆਂ ਦੇ ਖੇਡਣ ਵਾਸਤੇ ਥੋੜ੍ਹਾ ਟਾਈਮ ਅਸੀਂ ਉੱਥੇ ਵੀ ਬਿਤਾਵਾਂਗੇ ਅਤੇ ਫਿਰ ਅਸੀਂ ਐਂਡ 'ਚ ਜਿਹੜਾ ਕਿ ਹਰਿਮੰਦਰ ਸਾਹਿਬ ਜਾਵਾਂਗੇ ਉੱਥੇ ਰਾਤ ਰੁਕਣਾ ਅਸੀਂ ਹੈ ਨਾ ਮੱਥਾ ਮੁੱਥਾ ਟੇਕ ਕੇ ਫਿਰ ਅਗਲੇ ਦਿਨ ਜਿਹੜਾ ਕਿ ਵਾਪਸ ਆਉਣਾ ਹੈ ਅਤੇ ਵਾਪਸ ਆਉਂਦਿਆਂ ਫਿਰ ਅਸੀਂ ਜਿੱਦਾਂ ਕਿ ਲ ਜਿਹੜਾ ਬਾਘਾ ਬੌਰਡਰ ਹੈ ਕਰਤਾਰਪੁਰ ਸਾਹਿਬ ਦਾ ਉਹ ਵੀ ਦੇਖ ਕੇ ਆਵਾਂਗੇ ਅਤੇ ਆਉਂਦਿਆਂ ਫਿਰ ਹਵੇਲੀ ਜਿਵੇਂ ਟਾਈਮ ਥੋੜ੍ਹਾ ਜਿਹਾ ਉੱਥੇ ਵੀ ਰੁਕਾਂਗੇ ਅਤੇ ਫਿਰ ਵਾਪਸ ਆ ਕੇ ਜਿਵੇਂ ਹੁਣ ਸਾਡੇ ਜਿਹੜੇ ਥੋੜ੍ਹੇ ਜਿਹੇ ਕੋਈ ਮੈਂਬਰ ਨੇ ਹੈ ਨਾ ਜਿਨ੍ਹਾਂ ਨੇ ਨਵਾਂ ਸ਼ਹਿਰ ਉਤਰਨਾ ਉਹਨਾਂ ਨੂੰ ਵੀ ਉੱਥੇ ਰੋਕ ਕੇ ਮਾੜਾ ਜਿਹਾ ਥੋੜ੍ਹਾ ਟਾਈਮ ਰੋ ਮਤਲਬ ਰੋਕਾਂਗੇ ਹੈ ਨਾ ਅਤੇ ਮਤਲਬ ਜਿਵੇਂ ਆਪਾਂ ਨੂੰ ਇਸ ਕੰਮ ਲਈ ਨਾ ਕੈਬ ਚਾਹੀਦੀ ਸੀ ਕਿ ਆਪਾਂ ਜਿਵੇਂ ਛੱਬੀ ਤਰੀਕ ਨੂੰ ਜਾਣਾ ਸੀਗਾ ਛੱਬੀ ਜਿੱਦਣ ਸੰਡੇ ਹੈ ਹਨਾ ਉੱਦਣ ਜਾਣਾ ਸੀਗਾ ਅਤੇ ਸਵੇਰੇ ਆਪਾਂ ਮਤਲਬ ਜਿਵੇਂ ਕਿ ਇੱਥੋਂ ਚਾਰ ਕੁ ਵਜੇ ਨਾ ਸ ਟਾਇਮ ਦੇ ਨਾਲ ਨਿਕਲ ਜਾਣਾ ਹੈ ਅਤੇ ਮੇਰਾ ਐਡਰੈਸ ਸੇਧਾ ਮਾਜਰਾ ਹੈ ਹੈ ਨਾ ਸੇਧਾ ਮਾਜਰਾ ਸਰਕਾਰੀ ਸਕੂਲ ਦੇ ਸਾਹਮਣੇ ਮੇਰਾ ਘਰ ਹੈ ਕਿ ਉੱਥੇ ਜਿਹੜੀ ਇਹ ਟੈ ਕੈਬ ਹੈ ਪੂਰੇ ਟਾਈਮ 'ਤੇ ਤੁਸੀਂ ਪਹੁੰਚਾ ਦਿਉ ਅਤੇ ਜਿਹੜੀ ਬਣਦੀ ਤੁਹਾਡੀ ਪੇਮੈਂਟ ਹੈ ਉਹ ਅਸੀਂ ਮਿਲ ਕੇ ਡਰਾਈਵਰ ਨੂੰ ਦੇ ਦੇਵਾਂਗੇ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ